ਮੇਰੇ ਸ਼ਹਿਰ ਪਟਿਆਲੇ ਵਿੱਚ ਬਹੁਤ ਹੀ ਜ਼ਿਆਦਾ ਹਸਪਤਾਲ ਹਨ ਜੋ ਕਿ ਜਣੇਪਾ ਦੇਖਭਾਲ ਅਤੇ ਬੱਚਿਆਂ ਦੀ ਦੇਖਭਾਲ ਲਈ ਬਹੁਤ ਹੀ ਮਸ਼ਹੂਰ ਹਨ ਜਿਵੇਂ ਕਿ ਸਰਕਾਰੀ ਹਸਪਤਾਲ ਰਜਿੰਦਰਾ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਕਿਉਂਕਿ ਇਸ ਹਸਪਤਾਲ ਵਿੱਚ ਬਹੁਤ ਜ ਜ਼ਿਆਦਾ ਸੁਵਿਧਾ ਉਪਲਬਧ ਹਨ ਨਾਲ ਹੀ ਨਾਲ ਕਾਫੀ ਸਾਰੇ ਪ੍ਰਾਈਵੇਟ ਹਸਪਤਾਲ ਅਤੇ ਛੋਟੇ ਛੋਟੇ ਕਲੀਨਿਕ ਜੋ ਕਿ ਬੱਚਿਆਂ ਦੀ ਦੇਖਭਾਲ ਲਈ ਮਸ਼ਹੂਰ ਹਨ ਜਿਵੇਂ ਕਿ ਪਿਛਲੇ ਮਹੀਨੇ ਮੇਰੀ ਭੈਣ ਕੋਲ ਮੁੰਡਾ ਹੋਇਆ ਤਾਂ ਅਸੀਂ ਅਸੀਂ ਰਜਿੰਦਰਾ ਹਸਪਤਾਲ ਗਏ ਅਤੇ ਮੈਨੂੰ ਉੱਥੇ ਜਾ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਉਨ੍ਹਾਂ ਨੇ ਮੇਰੀ ਭੈਣ ਦੇ ਬੇਟੇ ਲਈ ਬਹੁਤ ਹੀ ਜ਼ਿਆਦਾ ਸੁਰੱਖਿਆ ਰੱਖੀ ਉਸਨੂੰ ਟਿਊਬਾਂ ਵਿੱਚ ਰੱਖਿਆ ਅਤੇ ਨਾਲ ਹੀ ਨਾਲ ਇੱਥੇ ਐਂਬੂਲੈਂਸ ਦਾ ਵੀ ਖਾਸ ਪ੍ਰਬੰਧ ਹੈ ਅਤੇ ਇਸ ਹਸਪਤਾਲ ਦਾ ਖਰਚਾ ਵੀ ਕੋਈ ਜ਼ਿਆਦਾ ਨਹੀਂ ਹੈ ਅਤੇ ਮੈਨੂੰ ਯਾਦ ਹੈ ਕਿ ਇਸ ਦਾ ਬਿੱਲ ਤਕਰੀਬਨ ਪੰਜ ਕੁ ਹਜ਼ਾਰ ਬ ਬ ਬਣਿਆ ਸੀ ਜੋ ਕਿ ਬਹੁਤ ਜ਼ਿਆਦਾ ਨਹੀਂ ਹੈ ਅਤੇ ਨਾਲ ਹੀ ਨਾਲ ਇਸ ਹਸਪਤਾਲ ਵਿੱਚ ਹੋਰ ਵੀ ਬਥੇਰੀਆਂ ਸੁਵਿਧਾ ਉਪਲਬਧ ਹਨ ਅਤੇ ਇਹ ਹਸਪਤਾਲ ਚੌਵੀ ਘੰਟੇ ਖੁੱਲ੍ਹਾ ਰਹਿੰਦਾ ਹੈ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਜਾ ਕੇ ਇਸ ਹਸਪਤਾਲ ਵਿੱਚ ਕੋਈ ਵੀ ਸੁਵਿਧਾ ਸੁਵਿਧਾ ਦਾ ਆਨੰਦ ਲੈ ਸਕਦਾ